ਸਤਿ ਸ਼੍ਰੀ ਅਕਾਲ ਮੈਮ ਜੀ ਮੈਂ ਕਮਲਜੀਤ ਮੈਂ ਡੀ ਡੀ ਮਿੱਤਲ ਟੋਵਰ ਕੋਲ ਨਾ ਨਵੀਂ ਰਹਿਣ ਆਈ ਹਾਂ ਜੀ ਬਠਿੰਡਾ ਅਤੇ ਮੈਨੂੰ ਮਕਾਨ ਮਾਲਕ ਨੇ ਜੀ ਤੁਹਾਡਾ ਨੰਬਰ ਦਿੱਤਾ ਸੀ ਅਤੇ ਮੈਂ ਨਵੀਆਂ ਨਵੀਆਂ ਥਾਵਾਂ ਵਿਜਿਟ ਕਰਨਾ ਚਾਹੁੰਦੀ ਹਾਂ ਵੀ ਕੱਲ੍ਹ ਛੁੱਟੀ ਸੀ ਇਸ ਲਈ ਮੈਂ ਆਪਦੀ ਪਰਿਵਾਰ ਸਮੇਤ ਜਾਣਾ ਚਾਹੁੰਦੀ ਸੀ ਕਿ ਵੀ ਮੈਨੂੰ ਤੁਸੀਂ ਦੱਸ ਸਕਦੇ ਆ ਵੀ ਕਿਹੜੀਆਂ ਕਿਹੜੀਆਂ ਨਵੀਆਂ ਥਾਵਾਂ ਨੇ ਜੋ ਮੈਂ ਇੱਥੇ ਦੇਖ ਸਕਾਂ

ਓਕੇ ਮੈਮ ਓਕੇ ਓਕੇ

ਓਕੇ ਮੈਮ ਟਰੈਵਲਿੰਗ ਵੀ ਮੈਨੂੰ ਇਹ ਸੀ ਕੋਈ ਬੱਸ ਵਗੈਰਾ ਕੋਈ ਆਟੋ ਵਗੈਰਾ ਵਗੈਰਾ ਦਾ ਹੋ ਜਾਂਦਾ ਕੋਈ ਸਾਧਨ ਮਤਲਬ ਕਿੰਨੀ ਕੁ ਦੂਰ ਪੈ ਜਾਂਦਾ ਅਤੇ ਕਿੰਨਾ ਕੁ ਮਤਲਵ ਕਰਾਇਆ ਲੱਗਦਾ ਜੀ

ਓਕੇ ਮੈਮ ਓਕ ਓਕੇ ਓਕੇ ਥੈਂਕ ਯੂ ਮੈਮ ਬਹੁਤ ਬਹੁਤ ਮਿਹਰਬਾਨੀ